ਹੈਲੋ ਮੋਟੋ ਰਾਈਡ ਭਾਜੀ ਮੈਂ ਹੁਣੇ ਨਾ ਤੁਹਾਡੀ ਐਪ ਤੋਂ ਇੱਕ ਟੈਕਸੀ ਬੁੱਕ ਕੀਤੀ ਹੈ ਅਤੇ ਮੈਂ ਚੰਡੀਗੜ੍ਹ ਤੋਂ ਮੋਹਾਲੀ ਜਾਣਾ ਹੈ ਅਤੇ ਕੀ ਤੁਸੀਂ ਇਸ ਰਾਈਡ ਲਈ ਕੈਸ਼ ਐਕਸੈਪਟ ਕਰੋਗੇ ਭਾਜੀ ਪਹਿਲਾਂ ਤਾਂ ਤੁਸੀਂ ਕਹਿ ਰਹੇ ਸੀ ਕਿ ਕੈਸ਼ ਐਕਸੈਪਟ ਕਰੋਗੇ ਤੁਸੀਂ ਅਤੇ ਹੁਣ ਇੱਥੇ ਆ ਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੈਸ਼ ਨਹੀਂ ਲੈਂਦੇ ਮੈਨੂੰ ਪੇਟੀਐਮ ਰਾਹੀਂ ਜਾਂ ਕਿਸੇ ਹੋਰ ਐਪ ਰਾਹੀਂ ਪੇਅ ਕਰੋ